ਮੇਰੇ ਘਰ ਬਹੁਤ ਸਾਰੇ ਮਹਿਮਾਨ ਆਏ ਸਨ ਅਤੇ ਹਾਲ ਵਿੱਚ ਹੀ ਮੈਂ ਔਡਰ ਕੀਤਾ ਸੀ ਖਾਣਾ ਬਹੁਤ ਸਾਰਾ ਔਡਰ ਕੀਤਾ ਸੀ ਜਿਸ ਵਿੱਚ ਮੈਂ ਸ਼ਾਹੀ ਪਨੀਰ ਦਾਲ ਮੱਖਣੀ ਨਾਨ ਅਤੇ ਰੋਟੀ ਵਗੈਰਾ ਔਡਰ ਕੀਤੀ ਸੀ ਪਰ ਮਹਿਮਾਨ ਚਲੇ ਜਾਣ ਕਰਕੇ ਮੈਂ ਉਸ ਔਡਰ ਨੂੰ ਕੈਂਸਲ ਕਰਨਾ ਚਾਹੁੰਦੀ ਸੀ ਜੋ ਕੈਂਸਲ ਨਹੀਂ ਹੋ ਰਿਹਾ ਸੀ ਮੈਂ ਉਸਦੇ ਦੁਕਾਨ ਵਾਲੇ ਦੁਕਾਨ ਦੇ ਦੁਕਾਨਦਾਰ ਨੂੰ ਕੌਲ ਕਰਕੇ ਉਸ ਔਡਰ ਨੂੰ ਕੈਂਸਲ ਕਰਨ ਨੂੰ ਆਖਿਆ ਜੋ ਹੋ ਨਹੀਂ ਪਾਇਆ ਅਤੇ ਫਿਰ ਮੈਂ ਹੁਣ ਜਮੈਟੋ ਐਪ 'ਤੇ ਇਸ ਔਡਰ ਨੂੰ ਕੈਂਸਲ ਕਰ ਰਹੀ ਹਾਂ ਤਾਂ ਜੋ ਮੈਨੂੰ ਇਸ ਖਾਣੇ ਦੀ ਹੁਣ ਇੱਕ ਵਾਰ ਲੋੜ ਨਹੀਂ ਹੈ ਕਿਉਂਕਿ ਮੇਰੇ ਮਹਿਮਾਨ ਜਾ ਚੁੱਕੇ ਹਨ ਇਸ ਲਈ ਮੈਂ ਇਸ ਖਾਣੇ ਦੇ ਔਡਰ ਨੂੰ ਕੈਂਸਲ ਕਰ ਰਹੀ ਹਾਂ